ਹੈਲੋ ਸਤਿ ਸ਼੍ਰੀ ਅਕਾਲ ਵਧੀਆ ਤੁਸੀਂ ਸੁਣਾਓ ਆਪਣਾ ਹਾਂਜੀ ਵੈਸੇ ਤੇ ਪਠਾਨਕੋਟ ਮਤਲਬ ਸਾਰੀ ਚੀਜ਼ਾਂ ਇੱਥੇ ਮਤਲਬ ਵਧੀਆ ਹੀ ਮਿਲਦੀਆਂ ਅਤੇ ਖਾਣ ਪੀਣ ਦੇ ਮਾਮਲੇ 'ਚ ਜਾਂ ਫਿਰ ਤੁਸੀਂ ਕੁਛ ਵੀ ਮਤਲਬ ਬਾਹਰ ਫਾਸਟ ਫੂਡ ਖਾਣਾ ਕੁਛ ਵੀ ਮਤਲਬ ਖਾਣਾ ਪਠਾਣ ਪਠਾਨਕੋਟ 'ਚ ਹਰ ਇੱਕ ਚੀਜ਼ ਤਾਂ ਹੈ ਅਤੇ ਵਧੀਆ ਹੀ ਹੈ ਇੱਦਾਂ ਪਰ ਜਿੱਦਾਂ ਕਿ ਹੁਣ ਤੁਸੀਂ ਮਤਲਬ ਜਿੱਦਾਂ ਰੋਟੀ ਕਿਸੇ ਨੇ ਮੰਗਵਾਉਣੀ ਹੋਏ ਜਿੱਦਾਂ ਉੱਥੇ ਇੱਥੇ ਢਾਬੇ ਦੋ ਫੇਮਸ ਇੱਦਾਂ ਇਹ ਕਿੰਨਾ ਫੇਮਸ ਮਤਲਬ ਇੱਥੇ ਕਾਫੀ ਸਾਰੇ ਢਾਬੇ ਹੈ ਔਰ ਜਦੋਂ ਤੁਸੀਂ ਫਾਸਟ ਫੂਡ ਖਾਣਾ ਹੋਵੇ ਫਾਸਟ ਫੂਡ ਵਾਸਤੇ ਜਿੱਦਾਂ ਤੁਸੀਂ ਮਤਲਬ ਇੱਕ ਆਈਸਕ੍ਰੀਮ ਵਾਸਤੇ ਸਪੈਸ਼ਲ ਜਿਹੜਾ ਮਤਲਬ ਫੇਮਸ ਆ ਉਹ ਵੈਲੇਨਟਾਈਨ ਹੋ ਗਿਆ ਅਤੇ ਹੋਰ ਜਿੱਦਾਂ ਕਿ ਤੁਸੀਂ ਪੀਜ਼ਾ ਖਾਣਾ ਹੋਏ ਪੀਜ਼ਾ ਵਾਸਤੇ ਤਾਂ ਵੈਸੇ ਕਾਫੀ ਵਧੀਆ ਵਧੀਆ ਇੱਥੇ ਜਿੱਦਾਂ ਹੰਗਰੀ ਪੁਆਇੰਡ ਡੋਮੀਨੋਜ਼ ਬਸ ਇਹ ਮਤਲਬ ਕਿ ਇੱਦਾਂ ਦੀ ਕਾਫੀ ਚੀਜ਼ਾਂ ਹੈ ਆ ਹੋਰ ਤੁਹਾਨੂੰ ਨਾਨ ਪਸੰਦ ਹੈ ਕਿਸੇ ਵੀ ਮਤਲਬ ਨਾਨ ਦੀ ਮਤਲਬ ਪਟੇਲ ਚੌਂਕ ਦੇ ਸਾਹਮਣੇ ਗੁਡ ਮੋਰਨਿੰਗ ਹੈ ਉੱਥੇ ਮਤਲਬ ਕਾਫੀ ਵਧੀਆ ਮਤਲਬ ਪ੍ਰਾਈਜ ਵੀ ਉਹਨਾਂ ਦੀ ਸਹੀ ਹੁੰਦੀ ਹੈ ਅਤੇ ਉਹ ਨਾਨ ਕੁਆਲਿਟੀ ਇਹਨਾਂ ਦੀ ਕਾਫੀ ਸਹੀ ਹੁੰਦੀ ਹੈ ਹਾਂਜੀ ਅਤੇ ਸਾਡੇ ਇੱਥੇ ਮਤਲਬ ਦੋ ਸਪੈਸ਼ਲ ਜਿਹੜੇ ਫੇਮਸ ਹੈ ਇੱਕ ਮੱਖਣ ਦਾ ਢਾਬਾ ਅਤੇ ਕਸ਼ਾਨੀ ਦੀ ਹੱਟੀ ਹੈ ਜਿਹੜੀ ਇਹ ਦੋਨੋਂ ਮਤਲਬ ਬੜੇ ਜ਼ਿਆਦਾ ਫੇਮਸ ਹੈ ਕਿ ਮਤਲਬ ਘਰ ਦੀ ਰੋਟੀ ਵਰਗੀ ਹੁੰਦੀ ਹੈ ਅਤੇ ਜ਼ਿਆਦਾ ਮਸਾਲੇ ਵੀ ਨਹੀਂ ਪਾਏ ਜਾਂਦੇ ਉਹਨਾਂ ਨੇ ਕਿ ਜ਼ਿਆਦਾ ਮਸਾਲੇ ਆ ਅਤੇ ਮਤਲਬ ਵਧੀਆ ਹੁੰਦਾ ਖਾਣਾ ਵੀ ਇੱਥੋਂ ਦਾ ਜਿੱਦਾਂ ਬੰਦਾ ਘਰ ਦਾ ਹੀ ਖਾ ਖਾਏ ਕਰਦਾ ਇੱਥੇ ਖਾਣਾ ਅਤੇ ਹੋਮ ਡਿਲੀਵਰੀ ਵੀ ਹਾਂਜੀ ਹਾਂਜੀ ਹੋਮ ਡਿਲੀਵਰੀ ਵੀ ਹੋ ਜਾਂਦੀ ਹੈ